ਜੇ ਆਪਾਂ ਧਰਮ ਦੀ ਗੱਲ ਕਰੀਏ ਤਾਂ ਮੈਂ ਸਿੱਖ ਧਰਮ ਨੂੰ ਮੰਨਦਾ ਹਾਂ ਕਿਉਂਕਿ ਮੇਰੀ ਪੈਦਾਇਸ਼ ਹੀ ਸਿੱਖ ਧਰਮ ਦੇ ਵਿੱਚ ਹੋਈ ਹੈ ਇੱਕ ਪਰਿਵਾਰ ਜੋ ਸਿੱਖ ਧਰਮ ਨੂੰ ਮੰਨਦਾ ਹੈ ਅਤੇ ਸਾਡੇ ਘਰ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਅਤੇ ਮੇਰਾ ਜਿਹੜਾ ਰਿਹਾਇਸ਼ ਆ ਸਰਹੰਦ ਸ਼ਹਿਰ ਹੋਣ ਕਰਕੇ ਜਿੱਥੇ ਕਿ ਛੋਟੇ ਸਾਹਿਬਜ਼ਾਦੇ ਸ਼ਹੀਦੀ ਹੋਈ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਛੋਟੇ ਪੁੱਤਰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਸਰਹੰਦ ਵਿੱਚ ਹੋਈ ਸੀ ਅਤੇ ਇਹ ਬੜੀ ਇਤਿਹਾਸਿਕ ਥਾਂ ਹੈ ਜਿੱਥੇ ਛੋਟੀਆਂ ਜਿੰਦਾਂ ਨੇ ਵੱਡਾ ਸਾਕਾ ਕਰਕੇ ਦਿਖਾਇਆ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਅਤੇ ਹਰ ਸਾਲ ਇੱਥੇ ਸ਼ਹੀਦੀ ਜੋੜ ਮੇਲ ਹੁੰਦਾ ਹੈ ਜਿਸ ਦੇ ਵਿੱਚ ਦੂਰੋਂ ਨੇੜਿਓ ਸੰਗਤ ਆਉਂਦੀ ਹੈ ਹੁੰਮ ਹੁੰਮਾ ਕੇ ਪਹੁੰਚਦੇ ਹਨ ਅਤੇ ਜਿਹੜੇ ਆ ਦਸੰਬਰ ਦਾ ਮਹੀਨਾ ਚੱਲ ਰਿਹਾ ਹੁਣ ਇਸ ਸਾਲ ਜਿਵੇਂ ਹੁਣ ਛੱਬੀ ਸਤਾਈ ਅਠਾਈ ਦਾ ਇਹ ਪ੍ਰੋਗਰਾਮ ਹੈ ਕਿ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ ਅਤੇ ਉਰੇ ਆ ਕੇ ਨਤਮਸਤਕ ਹੁੰਦੀਆਂ ਨੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੀਆਂ ਨੇ ਅਤੇ ਉਹਦੇ ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਪ੍ਰੋਗਰਾਮ ਹੁੰਦਾ ਜਿਵੇਂ ਕਿ ਅਖੰਡ ਪਾਠ ਸਾਹਿਬ ਰੱਖਿਆ ਜਾਂਦਾ ਇਹ ਤਿੰਨ ਦਿਨ ਚੱਲਦਾ ਅਤੇ ਦੀਵਾਨ ਲੱਗਦੇ ਹਨ ਅਲੱਗ ਅਲੱਗ ਜਗ੍ਹਾ 'ਤੇ ਬੜੇ ਥਾਵਾਂ 'ਤੇ ਲੰਗਰ ਲਗਾਏ ਜਾਂਦੇ ਹਨ ਕਿਉਂਕਿ ਸੰਗਤਾਂ ਬਹੁਤ ਦੂਰੋਂ ਆ ਰਹੀਆਂ ਹੁੰਦੀਆਂ ਅਤੇ ਬਹੁਤ ਗਿਣਤੀ ਵਿੱਚ ਆਉਂਦੀਆਂ ਨੇ ਜਿਸ ਕਰਕੇ ਵੀ ਉਹਨਾਂ ਦੇ ਖਾਣ ਪੀਣ ਦੇ ਵਿੱਚ ਕੋਈ ਕਮੀ ਨਾ ਹੋਵੇ ਤਾਂ ਇਸ ਕਰਕੇ ਲੰਗਰ ਹਰ ਜਗ੍ਹਾ ਹਰ ਜਿਹੜੀ ਸੜਕ ਜਿਹੜੀ ਜਿ ਜਿੱਥੋਂ ਵੀ ਐਂਟਰੀ ਹੁੰਦੀ ਹੈ ਜਿੱਥੋਂ ਵੀ ਇਸ ਸ਼ਹਿਰ ਨੂੰ ਐਂਟਰੀ ਹੁੰਦੀ ਉੱਥੇ ਕੋਈ ਨਾ ਕੋਈ ਲੰਗਰ ਜ਼ਰੂਰ ਲੱਗਿਆ ਮਿਲ ਜਾਂਦਾ ਇਹਨਾਂ ਦਿਨਾਂ ਵਿੱਚ ਇੱਥੇ ਕਾਫੀ ਰਸ਼ ਹੋ ਜਾਂਦਾ ਅਤੇ ਜਿਹੜੀ ਹੈ ਨਾ ਤਿੰਨ ਦਿਨ ਵਾਸਤੇ ਇੱਥੇ ਬੱਸਾਂ ਦੀ ਕਾਰਾਂ ਦੀ ਅੰਦਰ ਐਂਟਰੀ ਬੈਨ ਹੋ ਜਾਂਦੀ ਆ ਅਤੇ ਅਖੀਰਲੇ ਦਿਨ ਨਗਰ ਕੀਰਤਨ ਹੁੰਦਾ ਜਿਵੇਂ ਤੇਰ੍ਹਾਂ ਪੋਹ ਨੂੰ ਅਤੇ ਉਸ ਦਿਨ ਤਾਂ ਪੂਰਾ ਬੈਨ ਹੋ ਜਾਂਦਾ ਐਂਟਰੀ ਇਹਨਾਂ ਦੀ ਅਤੇ ਨਗਰ ਕੀਰਤਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਜੋਤੀ ਸਰੂਪ ਤੱਕ ਨਿਕਲਦਾ ਅਤੇ ਉਹਦੇ ਵਿੱਚ ਪਾਲਕੀ ਸਾਹਿਬ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਉਹ ਆਪਣਾ ਵੱਡੇ ਗੁਰਦੁਆਰਾ ਕਹਿੰਦੇ ਆ ਉਹਨਾਂ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਜੋਤੀ ਸਰੂਪ ਤੱਕ ਦਾ ਨਗਰ ਕੀਰਤਨ ਹੁੰਦਾ ਅਤੇ ਸੰਗਤਾਂ ਇਸ ਨੂੰ ਦੇਖਣ ਵਾਸਤੇ ਬਹੁਤ ਦੂਰੋਂ ਆਉਂਦੀਆਂ ਹਨ